ਭਾਰਤ ਭਾਰਤ ਵਿੱਚ ਬਹੁਤ ਸਾਰੇ ਫੈਮਸ ਖੇਡਾਂ ਨੇ ਮਗਰ ਜਿਹੜੀ ਪ੍ਰਸਿੱਧ ਖੇਡ ਹੈ ਉਹਨਾਂ ਦੇ ਵਿੱਚ ਆਪਣੀ ਚਿੜੀ ਛਿੱਕਾ ਹੋਈ ਆਪਣੇ ਬੌਕਸਿੰਗ ਹੋਈ ਅਤੇ ਨਾਲੇ ਭਾਰਤ ਦੀ ਜਿਹੜੀ ਨੈਸ਼ਨਲ ਗੇਮ ਹੈ ਉਹ ਹੋਕੀ ਹੈ ਹੁਣ ਪੰਜਾਬ ਦੇ ਵਿੱਚ ਵੀ ਹੋਕੀ ਬਹੁਤ ਖੇਡੀ ਜਾਂਦੀ ਹੈ ਪਕਾ ਭਾਰਤ ਪੰਜਾਬ ਦੇ ਸਕੂਲਾਂ ਦੇ ਵਿੱਚ ਤਾਂ ਹੋਰ ਵੀ ਖੇਡਾਂ ਖੇਡੀਆਂ ਜਾਂਦੀਆਂ ਨੇ ਮਗਰ ਜਿਵੇਂ ਪੀ ਪੀ ਵੀ ਸੰਧੂ ਆ ਮੈਰੀ ਕੌਮ ਆ ਇਹ ਇਹਨਾਂ ਦੇ ਮੁੱਖ ਖਿਡਾਰੀ ਨੇ ਖੇਡਾਂ ਦੇ ਪੀ ਬੀ ਸੰਧੂ ਜਿਹੜੀ ਹੈ ਨਾ ਉਹ ਆਪਣੇ ਚਿੜੀ ਛਿੱਕਾ ਜਿਹੜਾ ਖੇਡ ਖੇਡਦੇ ਨੇ ਉਹਦੀ ਆ ਮੈਰੀ ਕੌਮ ਜਿਹੜੀ ਆ ਉਹ ਬੌਕਸਿੰਗ ਦੀ ਆ ਅੱਜ ਕੱਲ੍ਹ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਖੇਡਾਂ ਦੇ ਨਾਲ ਨਾਲ ਪੜ੍ਹਾਈ ਕਰਾਈ ਜਾਂਦੀ ਹੈ ਪਹਿਲੇ ਦੇ ਟਾਈਮ ਵਾਂਗੂ ਨਹੀਂ ਕਿ ਇਕੱਲੇ ਪੜ੍ਹਾਈ ਜਾਓ ਪੜ੍ਹਾਈ ਜਾਓ ਅੱਜ ਕੱਲ੍ਹ ਖੇਡਾਂ ਦਾ ਬਹੁਤ ਮਹੱਤਵ ਹੈ ਇਹਦੇ ਨਾਲ ਸਰੀਰਿਕ ਆਪਣੀ ਮਜ਼ਬੂਤੀ ਬਣਦੀ ਆ ਦਿਮਾਗੀ ਵਿਕਾਸ ਹੁੰਦੇ ਹੈ ਬੱਚਿਆਂ ਦਾ ਠੀਕ ਆ ਇਸ ਲਈ ਖੇਡਾਂ ਸਾਡਾ ਸੰਪੂਰਨ ਵਿਕਾਸ ਕਰਦੀਆਂ ਨੇ